ਕੁਝ ਆਮ ਕੁਝ ਆਮ ਗਲਤੀਆਂ ਜਦ ਜਦੋਂ ਲੋਕ ਪਹਿਲੀ ਵਾਰ ਚਿੱਤਰਕਾਰੀ ਸ਼ੁਰੂ ਕਰਦੇ ਹਨ ਅਤੇ ਇਹਨਾਂ ਕੋਲੋਂ ਹੋ ਹੀ ਜਾਂਦੀਆਂ ਹਨ ਜਾਂ ਜਿਵੇਂ ਕਿ ਉਹਨਾਂ ਕੋਲੋਂ ਰੰਗ ਭਰਦੇ ਸਮੇਂ ਚਿੱਤਰ ਤੋਂ ਰੰਗ ਬਾਹਰ ਆ ਸਕਦਾ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਰੰਗ ਕਿੱਥੇ ਕਿਹੜੇ ਰੰਗ ਦਾ ਕਿੱਥੇ ਉਪਯੋਗ ਕਰਨਾ ਹੈ ਅਤੇ ਕਿਹੜਾ ਰੰਗ ਕਿੱਥੇ ਭਰਨਾ ਹੈ ਅਤੇ ਅਤੇ ਇਹ ਸਿਰਫ਼ ਸੰਭਵ ਹੈ ਅਗਰ ਇੱਕ ਵਿਅਕਤੀ ਲਗਾਤਾਰ ਅਭਿਆਸ ਕਰੇ ਅਤੇ ਮਿਹਨਤ ਕਰੇ ਕਿਉਂਕਿ ਅਭਿਆਸ ਕਰਨ ਨਾਲ ਇੱਕ ਕੋਈ ਵੀ ਵਿਅਕ ਵਿਅਕਤੀ ਕਿਸੇ ਵੀ ਚੀਜ਼ ਵਿੱਚ ਮਾਹਿਰ ਬਣ ਸਕਦਾ ਹੈ ਇਸ ਲਈ ਕਲਾਕਾਰ ਬਣਨ ਲਈ ਸਖ਼ਤ ਅਭਿਆਸ ਦੀ ਲੋੜ ਹੈ